ਖੁੱਲ੍ਹੇ ਪਾਣੀ ਵਿੱਚ ਤੈਰਾਕੀ ਕਰਦੇ ਸਮੇਂ ਸੁਰੱਖਿਅਤ ਰਹਿਣ ਦੇ ਕੁਝ ਤਰੀਕੇ ਹਨ ਕਿ ਸਾਨੂੰ ਸ ਪਹਿਲੇ ਨੰਬਰ 'ਤੇ ਸਵਿਮਿੰਗ ਆਉਣੀ ਚਾਹੀਦੀ ਹੈ ਦੁਜੇ ਨੰਬਰ 'ਤੇ ਸਾਡੇ ਕੋਲ ਕੁਝ ਐਸੀਆਂ ਵਸਤੂਆਂ ਹੋਣੀਆਂ ਚਾਹੀਦੀਆਂ ਹਨ ਕਿ ਅਸੀਂ ਆਪਦੇ ਆਪ ਨੂੰ ਪਾਣੀ ਵਿੱਚ ਸੰਭਾਲ ਸਕੀਏ ਅਤੇ ਆਪਦੇ ਆਪ ਨੂੰ ਸੁਰੱਖਿਅਤ ਰੱਖ ਸਕੀਏ ਇਸ ਕਰਕੇ ਸਾਨੂੰ ਪੂਰੀ ਸਾਵਧਾਨੀ ਨਾਲ ਖੁੱਲ੍ਹੇ ਪਾਣੀ ਵਿੱਚ ਤੈਰਾਕੀ ਕਰਨੀ ਚਾਹੀਦੀ ਹੈ ਵੱਡੇ ਪਾਣੀਆਂ ਜਿਵੇਂ ਕਿ ਤਿਲਕਣ ਵਾਲੀਆਂ ਚਟਾਨਾਂ ਵਿੱਚ ਤਿਲਕਣ ਵਾ ਵਾਲੀਆਂ ਚਟਾਨਾਂ ਵਿੱਚ ਸਾਨੂੰ ਆਪਣੇ ਆਪ ਨੂੰ ਸਾਨੂੰ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਕੁਝ ਇਹੋ ਜਿਹੀਆਂ ਵਸਤੂਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਆਪਦੇ ਅ ਆਪਦੀ ਸੰਭਾਲ ਕਰ ਸਕੀਏ ਐਲਗੀ ਤੇਜ਼ ਵਹਾ ਆਦਿ ਵਿੱਚ ਕੁਝ ਰੁਕਾਵਟਾਂ ਹਨ ਰੁਕਾਵਟਾਂ ਹਨ ਕਿ ਐਲਗੀ ਵਾਲੇ ਜਾਂ ਤੇਜ਼ ਵਹਾ ਵਾਲੇ ਪਾਣੀ ਵਿੱਚ ਸਾਡੇ ਸਾਡੇ ਜੀਵਨ ਨੂੰ ਕਾਫੀ ਜ਼ਿਆਦਾ ਅਸੁਰੱਖਿਆ ਅਸੁਰੱਖਿਆ ਪੈਦਾ ਹੋ ਸਕਦੀ ਹੈ ਇਸੇ ਕਰਕੇ ਸਾਨੂੰ ਤਿਲਕਣ ਵਾਲੀ ਜਾਂ ਤੇਜ਼ ਵਹਾਓ ਵਾਲੀ ਜਾਂ ਐਲਗੀ ਵਾਲੇ ਪਾਣੀ ਵਾਲੀਆਂ ਚਟਾ ਪਾਣੀ ਪਾਣੀਆਂ ਵਿੱਚ ਸਾਵਧਾਨੀ ਨਾਲ ਸਾਵਧਾਨੀ ਨਾਲ ਤੈਰਾਕੀ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕੀਏ